ਸਾਡੇ ਖੇਤਰ ਦੇ ਵਿੱਚ ਖੇਤਰੀ ਸੈਲਾਨੀ ਆਕਰਸ਼ਣ ਨੂੰ ਵਧਾਉਣ ਦੇ ਲਈ ਦੂਖਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ ਨੇ ਜਿਹੜੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਰਿਲੇਟਡ ਨੇ ਅਤੇ ਇਹ ਪਟਿਆਲਾ ਸ਼ਹਿਰ ਦੇ ਵਿੱਚ ਖੰਡਾ ਚੌਂਕ ਦੇ ਨੇੜੇ ਬਣਿਆ ਹੋਇਆ ਗੁਰਦੁਆਰਾ ਹੈਗਾ ਅਤੇ ਇੱਥੇ ਪੰਚਵੀਂ ਭਰਦੀ ਹੈਗੀ ਦੂਰੋਂ ਦੂਰੋਂ ਲੋਕ ਨੇ ਜਿਹੜੇ ਇੱਥੇ ਮੱਥਾ ਟੇਕਣ ਦੇ ਲਈ ਆਉਂਦੇ ਨੇ ਮਤਲਬ ਇੱਥੇ ਲੋਕ ਦੂਰੋਂ ਦੂਰੋਂ ਆਉਂਦੇ ਨੇ ਜਦੋਂ ਅਤੇ ਇੱਥੇ ਉਹਨਾਂ ਦੇ ਰਹਿਣ ਦੇ ਲਈ ਵੀ ਬਣਿਆ ਹੋਇਆ ਹੈਗਾ ਇੱਥੇ ਕਮਰੇ ਬਣੇ ਹੋਏ ਹੈਗੇ ਉਹਨਾਂ ਨੂੰ ਕਮਰੇ ਮਿਲਦੇ ਹੈਗੇ ਅਤੇ ਲੋਕ ਦੂਰੋਂ ਦੂਰੋਂ ਆ ਕੇ ਇੱਥੇ ਰਹਿੰਦੇ ਹੈਗੇ ਪੰਚਮੀ 'ਤੇ ਆਉਂਦੇ ਹੈਗੇ ਅਤੇ ਇਹ ਜਿਹੜਾ ਗੁਰਦੁਆਰਾ ਹੈਗਾ ਨੌਵੇਂ ਗੁਰੂ ਤੇਗ ਬਹਾਦਰ ਜੀ ਨਾਲ ਰਿਲੇਟਡ ਹੈਗਾ ਉਹ ਇੱਥੇ ਆਏ ਸੀਗੇ ਅਤੇ ਉਹਨਾਂ ਦੇ ਆਉਣ ਤੋਂ ਬਾਅਦ ਜਿਹੜਾ ਇਹ ਇੱਥੇ ਤੇ ਗੁਰਦੁਆਰਾ ਬਣਿਆ ਸੀਗਾ ਅਤੇ ਇਸੇ ਤਰੀਕੇ ਨਾਲ ਸਾਡੇ ਸ਼ਹਿਰ ਦੇ ਵਿੱਚ ਬਹਾਦਰਗੜ੍ਹ ਸਾਹਿਬ ਵਿਖੇ ਗੁਰਦੁਆਰਾ ਬਣਿਆ ਹੋਇਆ ਹੈਗਾ ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਰਿਲੇਟਡ ਹੈਗਾ ਜਦੋਂ ਉਹ ਜੰਗ ਦੇ ਵਿੱਚ ਗੁਰੂ ਪਾਤਸ਼ਾਹ ਜੀ ਜਾ ਰਹੇ ਸੀਗੇ ਤਾਂ ਜੰਗ 'ਤੇ ਜਾਂਦੇ ਸਮੇਂ ਉਹ ਇੱਥੇ ਰੁਕੇ ਸੀਗੇ ਤਾਂ ਉਨਾਂ ਦੇ ਬਾਅਦ ਵੀ ਜਿਹੜਾ ਇਹ ਗੁਰਦੁਆਰਾ ਬਣਿਆ ਸੀਗਾ ਅਤੇ ਇੱਥੇ ਵੀ ਜਿਹੜੇ ਲੋਕ ਨੇ ਦੂਰੋਂ ਦੂਰੋਂ ਆਉਂਦੇ ਹੈਗੇ ਇੱਥੇ ਲਗਾਤਾਰ ਕੋਈ ਨਾ ਕੋਈ ਪਾਠ ਕੋਈ ਨਾ ਕੋਈ ਕੀਰਤਨ ਆ ਜਿਹੜਾ ਹੁੰਦਾ ਰਹਿੰਦਾ ਹੈਗਾ ਅਤੇ ਇਸੇ ਤਰੀਕੇ ਨਾਲ ਸਾਡੇ ਇੱਥੇ ਪਟਿਆਲਾ ਸ਼ਹਿਰ ਦੇ ਵਿੱਚ ਕਾਲੀ ਮਾਤਾ ਦਾ ਮੰਦਰ ਹੈਗਾ ਇਸ ਮੰਦਰ ਦੇ ਵਿੱਚ ਵੀ ਜਿਹੜੇ ਲੋਕ ਨੇ ਹਰ ਇੱਕ ਸ਼ਨੀਵਾਰ ਨੂੰ ਦੂਰੋਂ ਦੂਰੋਂ ਆਉਂਦੇ ਹੈਗੇ ਪੂਰੇ ਪੰਜਾਬ ਭਰ ਜਾਂ ਪੰਜਾਬ ਭਰ ਤੋਂ ਬਾਹਰੋਂ ਵੀ ਜਿਹੜੇ ਲੋਕ ਨੇ ਇੱਥੇ ਆ ਕੇ ਮੱਥਾ ਟੇਕਦੇ ਹੈਗੇ ਅਤੇ ਹਰ ਇੱਕ ਸ਼ਨੀਵਾਰ ਨੂੰ ਜਿਹੜਾ ਇਹ ਮੰਦਰ ਹੈਗਾ ਇਸ ਮੰਦਿਰ ਦੇ ਵਿੱਚ ਜਿਹੜੀ ਬਹੁਤ ਭੀੜ ਹੁੰਦੀ ਹੈਗੀ ਲੋਕਾਂ ਨੇ ਸ਼ਨੀਵਾਰ ਨੂੰ ਸਵੇਰ ਤੋਂ ਹੀ ਆਉਣਾ ਸਟਾਰਟ ਕਰ ਦੇਣਾ ਹੁੰ ਸਟਾਰਟ ਕਰ ਦਿੰਦੇ ਨੇ ਅਤੇ ਇਸੇ ਤਰੀਕੇ ਦੇ ਨਾਲ ਜਿਹੜੇ ਇਹ ਸਾਡੇ ਇਹ ਖੇਤਰੀ ਸਥਾਨਕ ਜਿਹੜੇ ਸੈਲਾਨੀ ਆਕਰਸ਼ਣ ਨੇ ਇਹ ਜਿਹੜੇ ਸਾਡੇ ਭਾਈਚਾਰੇ ਵਿੱਚ ਜਿਹੜੇ ਇਹ ਸੈਰ ਸਪਾਟੇ ਨੂੰ ਵਧਾਉਣ ਲਈ ਇੰਨਾ ਇਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈਗਾ ਇਨ੍ਹਾਂ ਦੇ ਲਈ ਜਿਹੜੇ ਸਾਡੇ ਲੋਕ ਨੇ ਮਤਲਬ ਇੱਥੇ ਆ ਕੇ ਰਹਿੰਦੇ ਨੇ ਇਹਨਾਂ ਨੂੰ ਦੇਖਦੇ ਹੈਗੇ ਜਿਹਦੇ ਨਾਲ ਜਿਹੜਾ ਇਹਨਾਂ ਦਾ ਆਕਰਸ਼ਣ ਆ ਉਹ ਵੱਧਦਾ ਹੈਗਾ